ਮੈਨੂੰ ਚਿੱਤਰਕਾਰੀ ਦਾ ਬਹੁਤ ਸ਼ੌਂਕ ਹੈ ਮੈਨੂੰ ਬਚਪਨ ਤੋਂ ਹੀ ਚਿੱਤਰਰਕਾਰੀ ਕਰਨਾ ਬਹੁਤ ਵਧੀਆ ਲੱਗਦਾ ਏ ਜਦੋਂ ਵੀ ਮੈਂ ਫਰੀ ਬੈਠ ਫਰੀ ਹੁੰਦੀ ਹਾਂ ਮੈਂ ਚਿੱਤਰਕਾਰੀ ਹੀ ਕਰਦੀ ਹਾਂ ਕਿਉਂਕਿ ਮੈਨੂੰ ਬਹੁਤ ਆਨੰਦ ਆਉਂਦਾ ਜਦੋਂ ਮੈਂ ਚਿੱਤਰਕਾਰੀ ਕਰਦੀ ਹਾਂ ਅਤੇ ਮੈਂ ਕੋਲ ਸਕੂਲ ਕੋਲਿਜ 'ਚ ਪਹਿਲਾਂ ਇੱਕ ਸਕੂਲ 'ਚ ਪਹਿਲਾਂ ਇੱਕ ਚੌਂਪੜੀ ਬਣਾਈ ਸੀਗੀ ਅਤੇ ਫਿਰ ਅਹ ਇੱਕ ਪਹਾੜਾਂ ਦਾ ਦ੍ਰਿਸ਼ ਬਣਾਇਆ ਸੀ ਇੱਕ ਘਰ ਦੇ ਨਾਲ ਅਤੇ ਉਦੋਂ ਮ ਮੇਰੇ ਟੀਚਰਸ ਨਾ ਟੀਚਰਸ ਨੇ ਵੀ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਸੀਗਾ ਅਤੇ ਕੋਈ ਵੀ ਸਕੂਲ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਕਿਸੇ ਵੀ ਤਰ੍ਹਾਂ ਦਾ ਕੋਈ ਫੰਕਸ਼ਨ ਹੁੰਦਾ ਸੀ ਤਾਂ ਜਦੋਂ ਉਹਦੇ ਵਿੱਚ ਚਿੱਤਰਕਾਰੀ ਦਾ ਚਿੱਤਰਕਾਰੀ ਹੁੰਦੀ ਸੀ ਤਾਂ ਮੈਂ ਉਹਦੇ 'ਚ ਹਰ ਵਾਰੀ ਪਾਰਟੀਸਪੇਟ ਕਰਦੀ ਸੀ ਅਤੇ ਮੇਰੀ ਹਰ ਵਾਰੀ ਕੋਈ ਨਾ ਫਸਟ ਪੁਜ਼ੀਸ਼ਨ ਹੀ ਆਉਂਦੀ ਸੀ ਅਤੇ ਮੈਨੂੰ ਉਸ ਉਸ ਤੋਂ ਮੈਨੂੰ ਬਹੁਤ ਮੋਟੀਵੇਸ਼ਨ ਮਿਲਦੀ ਮਿਲਦੀ ਅਤੇ ਫਿਰ ਅ ਇਸ ਤਰ੍ਹਾਂ ਕਿ ਇਸ ਤਰ੍ਹਾਂ ਮੈਂ ਅੱਗੇ ਅੱਗੇ ਹੁ ਅੱਜ ਹੁਣ ਤਾਂ ਪੰਜਾਬ ਯੂਨੀਵਰਸਟੀ ਨੇ ਵੀ ਆਰਟ ਐਂਡ ਕਰਾਫਟ ਆਰਟ ਫਨ ਬਹੁਤ ਕੋਰਸਿਜ ਦਿੱਤੇ ਹੋਏ ਨੇ ਅਤੇ ਮੇਰੀ ਮੇ ਮੇਰੀ ਮੇਰੀ ਬਹੁਤ ਇੱਛਾਵਾਂ ਏ ਕਿ ਮੈਂ ਇੱਕ ਵਧੀਆ ਵਧੀਆ ਆਰਟਿਸਟ ਆਰਟ ਐਂਡ ਕਰਾਫਟ ਕਰਾਂ ਕਿਉਂਕਿ ਮ ਮ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੀ ਆਰਟ ਦੇ ਥਰੂ ਹੀ ਲੋਕਾਂ 'ਚ ਲੋਕ ਲੋਕਾਂ 'ਚ ਮਸ਼ਹੂਰ ਹੋਵਾਂ ਤਾਂ ਕਿ ਜੋ ਮੇਰੀ ਆਰਟ ਦੇ ਥਰੂ ਹੀ ਲੋਕ ਮੈਨੂੰ ਜਾਨਣ ਕਿ ਮੇਰੀ ਆਰਟ ਨੂੰ ਦੇਖ ਕੇ ਦੇਖਣ ਕਿ ਕਿੰਨੀ ਵਧੀਆ ਆਰਟ ਹੈ ਅਤੇ ਅਤੇ ਮੈਂ ਬਹੁਤ ਯੋਜਨਾਵਾਂ ਕੀਤੀਆਂ ਤਾਂ ਮੈਂ ਹੁਣ ਗ੍ਰੈਜੂਏਸ਼ਨ ਤੋਂ ਬਾਅਦ ਵੀ ਯਾਦ ਵਿੱਚ ਬਾਅਦ ਚਾਹੁੰਦੀ ਹਾਂ ਕਿ ਜਿਹੜੀ ਪ੍ਰੋ ਪੋਸਟ ਗ੍ਰੈਜੂਏਸ਼ਨ ਹੈ ਜਿਹੜੀ ਮੈਂ ਆਪਣੀ ਆਰਟ ਐਂਡ ਕਰਾਫਟ ਦੇ ਵਿੱਚ ਕਰਾਂ ਅਤੇ ਮੈਨੂੰ ਬਹੁਤ ਅੰਦਰੋਂ ਸਕੂਨ ਮਿਲਦਾ ਏ ਜਦੋਂ ਮੈਂ ਕੋਈ ਵੀ ਆਰਟ ਕਰਦੀ ਹਾਂ ਜਾਂ ਕੁਛ ਚਿੱਤਰਕਾਰੀ ਕਿਸੇ ਵੀ ਚੀਜ਼ ਦੀ ਚਿੱਤਰਕਾਰੀ ਕਰਦੀ ਹਾਂ ਕੋਈ ਚੀਜ਼ ਦੇਖ ਕੇ ਉਹਦੀ ਚਿੱਤਰਕਾਰੀ ਕਰਨੀ ਉਹਨੂੰ ਰੀਪ੍ਰਜ਼ੈਂਟ ਕਰਨਾ ਮੈਨੂੰ ਅੰਦਰੋਂ ਵਧੀਆ ਫੀਲ ਹੁੰਦਾ ਕਿ ਹਾਂ ਵੀ